ਬੈਂਕ ਦੇ ਨਾਲ ਨਜਿੱਠਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਬੈਂਕ ਸਟਾਫ ਦਾ ਕੰਮ ਕਰਨ ਦਾ ਮਨ ਨਹੀਂ ਹੈ ਤਾਂ ਇਹ ਨਹੀਂ ਪਤਾ ਕਿ ਤੁਹਾਡਾ ਕਿੰਨਾ ਸਮਾਂ ਉਹ ਖ਼ਰਾਬ ਕਰਵਾ ਦੇਣ ਦੂਸਰਾ ਜੇਕਰ ਤੁਸੀਂ ਬੈਂਕ ਅੰਦਰ ਕੈਸ਼ ਜਮਾਂ ਕਰਵਾਉਣ ਵਾਸਤੇ ਜਾਓਗੇ ਤਾਂ ਤੁਹਾਨੂੰ ਕਾਫੀ ਲੰਬੀ ਕਤਾਰਾਂ ਦੇ ਵਿੱਚ ਖੜ੍ਹਾ ਹੋਣਾ ਪਵੇਗਾ ਜਿਸ ਨਾਲ ਤੁਹਾਡਾ ਸਮਾਂ ਵੀ ਕਾਫੀ ਖ਼ਰਾਬ ਹੋਏਗਾ ਤੀਸਰਾ ਇਹ ਹੈ ਕਿ ਕਈ ਵਾਰ ਅਸੀਂ ਕੀ ਦੇਖਿਆ ਹੈ ਕਿ ਬੈਕ ਐਂਡ 'ਤੇ ਬੈਂਕ ਦਾ ਸਿਸਟਮ ਬੰਦ ਹੋ ਜਾਂਦਾ ਹੈ ਜਿਸ ਨਾਲ ਉਹਨਾਂ ਦੇ ਪੀ ਸੀ ਕੰਮ ਕਰਨੋ ਬੰਦ ਹੋ ਜਾਂਦੇ ਹਨ ਜਿਸ ਨਾਲ ਤੁਹਾਡਾ ਕੰਮ ਤਿਉਂ ਦਾ ਤਿਉਂ ਰਹਿ ਜਾਂਦਾ ਹੈ ਅਤੇ ਅੱਗੇ ਨਹੀਂ ਵੱਧ ਪਾਉਂਦਾ ਚੌਥਾ ਜੇਕਰ ਤੁਸੀਂ ਆਪਣੇ ਬੈਂਕ ਦੇ ਵਿੱਚ ਨੈਫਟ ਜਾਂ ਆਰ ਟੀ ਜੀ ਐਸ ਕਰਵਾਉਣ ਜਾਂਦੇ ਹੋ ਤਾਂ ਜੇਕਰ ਤਾਂ ਤੁਸੀਂ ਚੈੱਕ ਉਥੇ ਸਿੱਟ ਕੇ ਬਾਹਰ ਆ ਜਾਓਗੇ ਤਾਂ ਉਹ ਆਰ ਟੀ ਜੀ ਐਸ ਸ਼ਾਮ ਦੇ ਛੇ ਵਜੇ ਜਾ ਕੇ ਹੋਏਗੀ ਅਤੇ ਜੇਕਰ ਤੁਸੀਂ ਉੱਥੇ ਬੈਠੇ ਜੇਕਰ ਤੁਸੀਂ ਉੱਥੇ ਬੈਠੇ ਰਹੋਂਗੇ ਤਾਂ ਹੀ ਉਹ ਤੁਹਾਡੇ ਬੈਠੇ 'ਤੇ ਉਹ ਅੱਗੇ ਕਰਨਗੇ ਕਈ ਵਾਰੀ ਕੀ ਹੁੰਦਾ ਹੈ ਕਿ ਜਿਸ ਬੰਦੇ ਨੂੰ ਆਪਾਂ ਪੈਸੇ ਪਾਉਣੇ ਹੁੰਦੇ ਹੈ ਉਸ ਨੂੰ ਕਈ ਵਾਰੀ ਅਤਿ ਜ਼ਰੂਰੀ ਹੁੰਦੀ ਹੈ ਜੇਕਰ ਤੁਸੀਂ ਕਾਹਲੀ ਦੇ ਵਿੱਚ ਚੈੱਕ ਉੱਥੇ ਰੱਖ ਕੇ ਬਾਹਰ ਨਿਕਲ ਆਏ ਤਾਂ ਇਹ ਨਹੀਂ ਪਤਾ ਉਹ ਬੈਂਕ ਸ਼ਾਮ ਤੱਕ ਤੁਹਾਡਾ ਚੈੱਕ ਹੀ ਨਾ ਪਾਸ ਕਰੇ